ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਸੁਰਜੀਤ ਕੁਮਾਰ ਪਠਾਨਕੋਟ ਤੋਂ ਬੋਲਦਾ ਹਾਂ ਜਦ ਕਿ ਆਪ ਨੂੰ ਪਤਾ ਹੈ ਕਿ ਮੈਨੂੰ ਘੁੰਮਣ ਦਾ ਬੜਾ ਸ਼ੌਕ ਹੈ ਅਤੇ ਘੁੰਮਣ ਦੇ ਨਾਲ ਨਾਲ ਮੈਨੂੰ ਖੇਤੀਬਾੜੀ ਦਾ ਵੀ ਬੜਾ ਸ਼ੌਕ ਹੈ ਜੋ ਕਿ ਮੇਰੇ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਖੇਤੀ ਅਤੇ ਫਸਲਾਂ ਦੀ ਰਾਖੀ ਕਰਨ ਲਈ ਸਾਨੂੰ ਤਾਂ ਪਹਿਲਾਂ ਆਪਣੇ ਖੇਤਾਂ ਦੀ ਚਾਰੋਂ ਤਰਫ ਬੋਂਡਰੀ ਕਰਨੀ ਚਾਹੀਦੀ ਹੈ ਬੋਂਡਰੀ ਨਹੀਂ ਤਾਂ ਕੋਈ ਤਾਰ ਦਾ ਇਸ ਤਰ੍ਹਾਂ ਦਾ ਘੇਰਾ ਬਣਾ ਸਕੀਏ ਜੋ ਕਿ ਪਸ਼ੂ ਅੰਦਰ ਨਾ ਆ ਸਕਣ ਅਗਰ ਅਗਰ ਤਾਰ ਬੋਂਡਰੀ ਲਾਨ ਦੇ ਬਾਵਜੂਦ ਵੀ ਕੋਈ ਪਸ਼ੂ ਅੰਦਰ ਆ ਜਾਂਦਾ ਹੈ ਤਾਂ ਉਹ ਕੀ ਨੁਕਸਾਨ ਕਰਦਾ ਹੈ ਨੁਕਸਾਨ ਉਹ ਕਿ ਜ਼ਿਆਦਾਤਰ ਖਾਂਦਾ ਘੱਟ ਹੈ ਅਤੇ ਨੁਕਸਾਨ ਜ਼ਿਆਦਾ ਕਰਦਾ ਹੈ ਬਾ ਬਾਤ ਕਰੀਏ ਤਾਂ ਛੋਟੇ ਛੋਟੇ ਪੰਛੀਆਂ ਦੀ ਪਸ਼ੂ ਪੰਛੀਆਂ ਪਸ਼ੂ ਜਾਨਵਰਾਂ ਦੀ ਜਦ ਕਿ ਖਰਗੋਸ਼ ਚੂਹੇ ਇੱਦਾਂ ਇਹਨਾਂ ਲਈ ਸਾਨੂੰ ਮਤਲਬ ਕੋਈ ਇੱਦਾਂ ਦੀ ਦਵਾਈ ਰੱਖਣੀ ਚਾਹੀਦੀ ਹੈ ਕਿ ਕਿਉਂਕਿ ਉਹ ਖਾਣ ਨਾਲ ਮਰ ਜਾਂਦੇ ਹਨ ਠੀਕ ਹੈ ਜਦ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ